ਸੁਤੰਤਰਤਾ ਅੰਦੋਲਨ ਦੇ ਕਈ ਨੇਤਾ ਹਨ ਪਰ ਮੈਨੂੰ ਭਗਤ ਸਿੰਘ ਜੀ ਪਸੰਦ ਹਨ ਕਿਉਂਕਿ ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕਈ ਲੜਾਈਆਂ ਲੜੀਆਂ ਉਹਨਾਂ ਦਾ ਜਨਮ ਅਠਾਈ ਸਤੰਬਰ ਨੂੰ ਹੋਇਆ ਸੀ ਉਹਨਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਬਹੁਤ ਕੁਝ ਕੀਤਾ ਉਹ ਉਹ ਜਦੋਂ ਜੇਲ ਵਿੱਚ ਕੈਦ ਹੋਏ ਤਾਂ ਉੱਥੇ ਰਹਿੰਦੇ ਕੈਦੀਆਂ ਦੀ ਤਰਸ ਯੋਗ ਹਾਲਤ ਦੇਖ ਉਹਨਾਂ ਨੇ ਜੇਲ ਵਿੱਚ ਭੁੱਖ ਹੜਤਾਲ ਕੀਤੀ ਤਾਂ ਜੋ ਉਹਨਾਂ ਉੱਥੇ ਰਹਿੰਦੇ ਕੈਦੀਆਂ ਨੂੰ ਚੰਗੀ ਸਹੂਲਤ ਮਿਲ ਸਕੇ ਚੰਗਾ ਖਾਣਾ ਮਿਲ ਸਕੇ ਅਤੇ ਜੇਲ ਵਿੱਚ ਰਹਿੰਦੇ ਹੋਏ ਉਹਨਾਂ ਨੂੰ ਪੜ੍ਹਨ ਲਈ ਕਿਤਾਬਾਂ ਵਗੈਰਾ ਮਿਲ ਸਕਣ